ਹੈਲੋ ਮੈਂ ਚੰਦਨ ਕਾਲੜਾ ਬੋਲ ਰਿਹਾ ਹਾਂ ਮੈਂ ਸੋਲ੍ਹਾਂ ਅਕ ਅਕਤੂਬਰ ਦੋ ਹਜ਼ਾਰ ਚੌਵੀ ਵਿੱਚ ਸੰਜੀਵ ਸਿਨੇਮੇ ਦੇ ਇੱਕ ਵਧਦਾ ਪੰਜਾਬ ਨਾਮ ਦੇ ਪਲੇ ਦੀ ਪਲੇ ਲਈ ਉਹਦੀ ਬੁਕਿੰਗ ਕਰਵਾਈ ਹੋਈ ਹੈ ਮੇਰਾ ਬੁਕਿੰਗ ਨੰਬਰ ਹੈ ਦੋ ਸੌ ਪੰਦਰ੍ਹਾਂ ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਮੇਰੀ ਬੁਕਿੰਗ ਕਨਫਰਮ ਹੋ ਚੁੱਕੀ ਹੈ ਜਾਂ ਨਹੀਂ ਹੋ ਚੁੱਕੀ ਹੈ